ਕੱਲ੍ਹ ਦੀ ਹੀ ਗੱਲ ਹੈ ਕਿ ਮੈਂ ਆਪਣੇ ਪਰਿਵਾਰ ਨਾਲ ਆਪਣੇ ਮਾਮੇ ਘਰ ਜਾਣ ਲਈ ਨਿਕਲਿਆ ਅਤੇ ਮੈਂ ਜਾਣ ਲਈ ਇੱਕ ਸਾਧਨ ਗੱਡੀ ਬੁੱਕ ਕੀਤੀ ਜੋ ਕਿ ਮੈਂ ਓਲਾ ਤੋਂ ਔਨਲਾਈਨ ਬੁੱਕ ਕੀਤੀ ਸੀ ਇਹ ਔਨਲਾਈਨ ਨੇ ਸਾਡਾ ਕੰਮ ਸੌਖਾ ਤਾਂ ਕਰ ਦਿੱਤਾ ਹੈ ਪਰ ਇਸ ਦੇ ਕਈ ਨੁਕਸਾਨ ਵੀ ਹਨ ਮੈਂ ਗੱਲ ਕੀਤੀ ਸੀ ਏਜੰਸੀ ਤੋਂ ਕਿ ਇਸ ਦਾ ਕਿਰਾਇਆ ਕਿੰਨਾਂ ਹੋਵੇਗਾ ਉਹਨਾਂ ਨੇ ਦੋ ਸੌ ਰੁਪਿਆ ਦੱਸਿਆ ਸੀ ਪਰ ਫਿਰ ਕੈਬ ਆ ਕੈਬ ਦੇ ਆਉਣ 'ਤੇ ਅਸੀਂ ਉਸ 'ਤੇ ਬਹਿ ਗਏ ਅਤੇ ਰਾਜਪੁਰੇ ਪਹੁੰਚਣ ਦਾ ਰਸਤਾ ਦੋ ਘੰਟੇ ਦਾ ਹੈ ਦੋ ਘੰਟੇ ਬਾਅਦ ਜਦੋਂ ਅਸੀਂ ਕੈਬ ਤੋਂ ਉਤਰੇ ਤਦ ਡਰਾਈਵਰ ਨੇ ਸਾਢੇ ਦੋ ਸੌ ਦੀ ਜਗ੍ਹਾ ਸਾਡੇ ਤਿੰਨ ਸੌ ਮੰਗੇ ਅਸੀਂ ਉਸ ਨੂੰ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਪੁੱਛਣ 'ਤੇ ਕਿਹਾ ਕਿ ਏਜੰਸੀ ਵਾਲਿਆਂ ਨੇ ਤਾਂ ਦੋ ਸੌ ਰੁਪਏ ਕਹੇ ਸੀ ਤਾਂ ਉਸ ਨੇ ਕਿਹਾ ਅਤੇ ਉਸ ਉਸਨੇ ਕਿਹਾ ਕਿ ਨਹੀਂ ਇਸ ਦੇ ਸਾਢੇ ਤਿੰਨ ਸੌ ਹੀ ਹੋਣਗੇ ਸਾਡੇ ਮਨ੍ਹਾ ਕਰਨ ਦੇ ਬਾਵਜੂਦ ਵੀ ਉਹ ਸਾਡੇ ਤੋਂ ਬਹਿਸ ਕਰਨ ਲੱਗਾ ਸਾਨੂੰ ਇਸਦਾ ਵਿਵਹਾਰ ਜਮ੍ਹਾਂ ਪਸੰਦ ਨਹੀਂ ਆਇਆ ਅਤੇ ਉਹ ਸਾਨੂੰ ਬੋਲਣ ਲੱਗ ਪਿਆ ਜਿਸ ਕਰਕੇ ਸਾਨੂੰ ਉਸ ਨੂੰ ਸਾਢੇ ਤਿੰਨ ਸੌ ਰੁਪਏ ਦੇਣੇ ਪੈ ਗਏ ਅਤੇ ਹੁਣ ਮੈਂ ਆਹ ਕੰਪਨੀ ਵਿੱਚ ਰਿਪੋਰਟ ਕਰ ਰਿਹਾ ਹਾਂ ਕਿ ਆਹ ਬਿਲਕੁਲ ਵੀ ਠੀਕ ਨਹੀਂ ਹੈ ਤੁਹਾਨੂੰ ਇਸ ਡਰਾਈਵਰ ਨੂੰ ਨੌਕਰੀ ਤੋਂ ਕੱਢਣਾ ਪਵੇਗਾ ਜਿਸ ਨਾਲ ਇਹ ਇਹ ਇਸ ਦੀ ਅਕਲ ਵੀ ਟਿਕਾਣੇ ਆ ਸਕੇ ਅਤੇ ਬਾਕੀ ਲੋਕਾਂ ਨਾਲ ਵੀ ਇਹੋ ਜਿਹਾ ਨਾ ਹੋਵੇ ਇਸ ਦੇ ਕਰਕੇ ਬਾਕੀ ਡਰਾਈਵਰ ਦਾ ਨਾਂ ਵੀ ਬਦਨਾਮ ਹੁੰਦਾ ਹੈ ਅਤੇ ਇਹ ਬਿਲਕੁਲ ਵੀ ਚੰਗਾ ਨਹੀਂ ਹੈ ਤੁਹਾਨੂੰ ਮੈਂ ਕਿਰਪਾ ਕਰਦਾ ਕਰਦਾ ਹਾਂ ਕਿ ਤੁਸੀਂ ਇਸ ਨੂੰ ਨੌਕਰੀ ਤੋਂ ਕੱਢ ਦਵੋ ਅਤੇ ਸਾਨੂੰ ਵੀ ਸਾਡੇ ਪੈਸੇ ਜਿਹੜੇ ਡੇਢ ਸੌ ਰੁਪਏ ਸੌ ਸੀਗੇ ਉਹ ਸਾਨੂੰ ਰਿਫੰਡ ਦਿੱਤਾ ਦੇ ਜਾਵੇ ਮੈਂ ਤੁਹਾਡਾ ਬਹੁਤ ਧੰਨਵਾਦੀ ਹੋਵਾਂਗਾ